ਮੁੱਖ ਤੌਰ 'ਤੇ ਸਾਡੇ ਖੇਤਰ ਵਿੱਚ ਸਾਰਿਆਂ ਤੋਂ ਵਧੀਆ ਫੈਸ਼ਨ ਡਿਜ਼ਾਇਨਿੰਗ ਨੂੰ ਮੰਨਿਆ ਗਿਆ ਹੈ ਅਤੇ ਇਸ ਕਰਕੇ ਹੀ ਸਾਡਾ ਖੇਤਰ ਚਰਚਾ ਵਿੱਚ ਰਹਿੰਦਾ ਹੈ ਕਿਉਂਕਿ ਸਾਡੇ ਖੇਤਰ ਦੇ ਲੋਕ ਫੈਸ਼ਨ ਡਿਜ਼ਾਇਨਿੰਗ ਕਰਕੇ ਹੀ ਫੇਮਸ ਰਹਿੰਦੇ ਹਨ ਇਹਨਾਂ ਕੋਲ ਜੋ ਅ ਸਕਿਲ ਹੈ ਹੈ ਨਾ ਉਹ ਬਹੁਤ ਵਧੀਆ ਹੈ ਕਿਉਂਕਿ ਇਹਨਾਂ ਨੇ ਬਹੁਤ ਹੀ ਵਧੀਆ ਯੂਨੀਵਰਸੀਸ ਦੇ ਵਿੱਚ ਇਹ ਸਕਿਲ ਲਈ ਗਈ ਹੈ ਅਤੇ ਜਦੋਂ ਵੀ ਕੋਈ ਵੀ ਆਉਂਦਾ ਹੈ ਜਦੋਂ ਸਾਡੇ ਖੇਤਰ ਦੇ ਲੋਕ ਕੋਈ ਵੀ ਮਤਲਬ ਉਸਨੂੰ ਬਣਾ ਕੇ ਪਾਉਂਦੇ ਹਨ ਅਤੇ ਦੂਜੇ ਲੋਕ ਉਸ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਅਤੇ ਫਿਰ ਉਹ ਕੋਪੀ ਕਰਦੇ ਹਨ ਅਤੇ ਇਸ ਐਵੇਂ ਹੀ ਜਦੋਂ ਵੀ ਅਸੀਂ ਫਿਲਮਾਂ ਦੇਖਦੇ ਹਾਂ ਅਤੇ ਸਾਡੇ ਖੇਤਰ ਦੇ ਲੋਕਾਂ ਦਾ ਮੁੱਖ ਤੌਰ 'ਤੇ ਉਹਨਾਂ ਦੇ ਵਿੱਚ ਉਹਨਾਂ ਦੇ ਕੱਪੜਿਆਂ ਨੂੰ ਲੈ ਕੇ ਹੀ ਦੇਖਦੇ ਹਨ ਕਿਉਂਕਿ ਉਸ ਤੋਂ ਉਹ ਉਹਨਾਂ ਦੇ ਕੱਪੜਿਆਂ ਬਾਰੇ ਦੇਖਦੇ ਹਨ ਅਤੇ ਫਿਰ ਉਸ ਹਿਸਾਬ ਨਾਲ ਉਹਨਾਂ ਨੂੰ ਸਟਿਚ ਕਰਦੇ ਹਨ ਅਤੇ ਜਦੋਂ ਕੋਈ ਵੀ ਬੰਦਾ ਆਪਣੇ ਕੱਪੜੇ ਪਾ ਕੇ ਜਾਂਦਾ ਹੈ ਤਾਂ ਦੂਜੇ ਖੇਤਰ ਦੇ ਲੋਕ ਉਹਨਾਂ ਤੋਂ ਪੁੱਛਦੇ ਹਨ ਕਿ ਉਹਨਾਂ ਨੇ ਕਿਵੇਂ ਸਟਿਚ ਕੀਤੇ ਕਿੱਥੋਂ ਸਟਿਚ ਕੀਤੇ